ਨੌਜਵਾਨ ਪੀੜ੍ਹੀ ਸੱਭਿਆਚਾਰਕ ਰੀਤਾਂ ਦੀ ਪਾਲਣਾ ਨਹੀਂ ਕਰ ਰਹੀ ਹੈ ਸਿਰਫ਼ ਦਿਖਾਵੇ ਦੇ ਤੌਰ 'ਤੇ ਸੱਭਿਆਚਾਰਕ ਰੀਤਾਂ ਦੀ ਪਾਲਣਾ ਕਰਦੀ ਹੈ ਜੋ ਕਿ ਬੇਹੱਦ ਹੀ ਨਿੰਦਣਯੋਗ ਹੈ ਸਾਡੀਆਂ ਸੱਭਿਆਚਾਰਕ ਰੀਤੀ ਰਿਵਾਜ਼ਾਂ 'ਤੇ ਢਿੱਲੀ ਪੈ ਰਹੀ ਪਕੜ ਹੈ ਇਸ ਦਾ ਇਹ ਕਾਰਨ ਹੈ ਕਿ ਅਸੀਂ ਖੁਦ ਹੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਵਿਰਾਸਤ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਆਪਣੇ ਰੀਤੀ ਰਿਵਾਜ਼ਾਂ ਨੂੰ ਬਚਾਉਣਾ ਹੈ ਹੁਣ ਦੇ ਸਮੇਂ ਵਿੱਚ ਲੱਚਰ ਗੀਤਾਂ ਲੱਚਰ ਗੀਤ ਨਹੀਂ ਲਗਾਉਣੇ ਚਾਹੀਦੇ ਅਤੇ ਬੱਚਿਆਂ ਨੂੰ ਪੁਰਾਣੇ ਰੀਤੀ ਰਿਵਾਜ਼ਾਂ ਅਤੇ ਸੱਭਿਆਚਾਰਕ ਬਾਰੇ ਸਮਝਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੱਭਿਆਚਾਰਕ ਨੂੰ ਸਮਝ ਅਤੇ ਨਾਲ ਜੁੜ ਸਕਣ ਇਸ ਕਰਕੇ ਸਾਨੂੰ ਲੱਚਰ ਗੀਤ ਨਹੀਂ ਲਗਾਉਣੇ ਚਾਹੀਦੇ ਸਗੋਂ ਸੱਭਿਆਚਾਰਕ ਹੀ ਗਾਣੇ ਲਗਾਉਣੇ ਚਾਹੀਦੇ ਅਤੇ ਸੱਭਿਆਚਾਰਕ ਚੀਜ਼ਾਂ ਹੀ ਦਿਖਾਉਣੀਆਂ ਚਾਹੀਦੀਆਂ ਹਨ ਜੋ ਸਮਝ ਵਿੱਚ ਬੱਚਿਆਂ ਦੇ ਆ ਸਕਣ ਅਗਲੀ ਪੀੜ੍ਹੀ ਇਸ ਤਰ੍ਹਾਂ ਹੀ ਸੱਭਿਆਚਾਰਕ ਰੀਤੀ ਰਿਵਾਜ਼ਾਂ ਨਾਲ ਜੁੜੀ ਰਹੇ